ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਕੌਣ ਅੱਛਾ ਓਕੇ ਮੈਮ ਹਾਂਜੀ ਹਾਂਜੀ ਹਾਂਜੀ ਅੱਛਾ ਕਾਹਦਾ ਮੈਮ ਅੱਛਾ ਅੱਠਾ ਮੈਮ ਚਲੋ ਬਹੁਤ ਵਧੀਆ ਗੱਲ ਹ ਅੱਛਾ ਹਾਂਜੀ ਬਿਲਕੁਲ ਸਹੀ ਗੱਲ ਹ ਮੈਮ ਐਕਟੀਵਿਟੀਜ ਵਗੈਰਾ ਤਾਂ ਹੋਣੀਆਂ ਚਾਹੀਦੀਆਂ ਹਾਂਜੀ ਹਾਂਜੀ ਬਹੁਤ ਵਧੀਆ ਸੋਚਿਆ ਮੈਮ ਤੁਸੀਂ

ਅੱਛਾ ਮੈਮ ਹੋਰ ਮੈਮ ਇਹਦੇ ਚ ਇਸ ਕਲੱਬ ਚੇ ਕੀ ਕੀ ਸਿਖਾਇਆ ਜਾਏਗਾ ਮਤਲਬ ਚੰਗੇ ਤਰਹਾਂ ਦੱਸ ਸਕਦੇ ਹੋ ਮੈਨੂੰ ਹਾਂਜੀ ਅੱਛਾ ਮੈਮ ਹੋਰ ਮੈਮ ਕਿਸ ਅੱਛਾ ਮੈਮ ਕਿਸ ਤਰ੍ਹਾਂ ਦੀ ਖੇਡਾਂ ਹੋਣਗੀਆਂ ਤੁਸੀਂ ਥੋੜਾ ਦੱਸ ਸਕਦੇ ਮੈਨੂੰ ਹਾ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹੋ ਗਈ ਮੈਂ ਹੀ ਸੋਚ ਰਹੀ ਸੀਗੀ ਕਿ ਵੱਡੇ ਬੱਚਿਆਂ ਤੋਂ ਜਿਆਦਾ ਕੰਪਟੀਸ਼ਨ ਹੁੰਦੇ ਆ ਇਧਰ ਮੈਂ ਖੇਡਾਂ ਵਿੱਚ ਛੋਟੇ ਬੱਚਿਆਂ ਨੂੰ ਤਾਂ ਮਤਲਬ ਇਹਨਾਂ ਨਹੀਂ ਇਨਵੋਲਵ ਕਰੀਦਾ ਹੁੰਦਾ ਹਨਾ ਮੈਂ ਵੀ ਉਹੀ ਸੋਚ ਰਹੀ ਸੀ ਇਹਨਾਂ ਦਾ ਵੀ ਕੁਝ ਹੋਣਾ ਚਾਹੀਦਾ ਚਲੋ ਤੁਸੀਂ ਬਹੁਤ ਵਧੀਆ ਇਹ ਸੋਚਿਆ ਖੇਡਾਂ ਵਗੈਰਾ ਬਾਰੇ ਐਕਟਿਵੀਟੀਜ਼ ਬਾਰੇ ਮੈਨੂੰ ਬਹੁਤ ਅੱਛਾ ਲੱਗਿਆ ਸੁਣ ਕੇ ਹਾਂਜੀ ਬਿਲਕੁਲ ਸਹੀ ਮੈਮ ਬਿਲਕੁਲ ਸਹੀ ਵੈਸੇ ਵੀ ਸਰਦੀਆਂ ਦੇ ਮੌਸਮ 'ਚ ਬੱਚੇ ਅੱਜ ਕੱਲ ਬਹੁਤ ਘੱਟ ਮਤਲਬ ਘੱਟਦੇ ਘੁਟਦੇ ਕਸਰਤ ਵੀ ਨਹੀਂ ਕਰਦੇ ਕੁਛ ਨਹੀਂ ਕਰਦੇ ਅੱਛਾ ਮੈਮ ਅੱਛਾ ਮੈਮ ਮੈਮ ਤੂਸੀਂ ਇਮਦਾ ਦੱਸ ਸਕਦੇ ਹੋ ਇਨ ਦਾ ਮਤਲਬ ਕਿ ਫੀਸ ਕੀ ਇਹਦਾ ਅੱਗੇ ਹੈਗੇ ਆ ਪ੍ਰੋਸੀਜਰ ਕੀ ਆ ਇਨ ਦਾ ਅੱਛਾ ਮੈਮ ਓਕੇ ਅੱਛਾ ਮੈਮ ਸੋ ਠੀਕ ਹ ਮੈਂ ਜਰੂਰ ਕਰੂੰਗੀ ਇਹ ਜਰੂਰ ਕਰੂਗੀ ਮੈਂ ਇਹ ਗੱਲ ਠੀਕ ਹ ਮੈਮ ਓਕੇ ਮੈਮ ਥੈਂਕਯੂ